ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੁਰੂ ਕਾਸ਼ੀ ਟ੍ਰਾਂਸਫਰ ਤੋਂ ਬੋਲਦੇ ਹੋ ਮੈਂ ਮਹਿਕ ਬੋਲਦੀ ਹਾਂ ਮੈਂ ਤੁਹਾਡੀ ਬਹੁਤ ਪੁਰਾਣੀ ਕਸਟਮਰ ਹਾਂ ਮੈਨੇ ਇੱਕ ਬੱਸ ਬੁੱਕ ਬੱਸ ਜਾਂ ਕੋਈ ਵੀ ਗੱਡੀ ਬੁੱਕ ਕਰਵਾਉਣੀ ਸੀ ਕਿਉਂਕਿ ਅਸੀਂ ਟੂਰ ਲੈ ਕੇ ਜਾਣਾ ਤਿੰਨ ਦਿਨਾਂ ਦਾ ਸ਼ਿਮਲਾ ਮਾਨਸਾ ਤੋਂ ਸ਼ਿਮਲਾ ਤਾਂ ਸਾਨੂੰ ਕਿਹੜੀ ਗੱਡੀ ਵਧੀਆ ਰਹੇਗੀ ਅਸੀਂ ਪੰਦਰਾਂ ਜਣੇ ਹਾਂ ਅਤੇ ਉੱਥੇ ਜਾਣ ਦੇ ਕਿੰਨੇ ਚਾਰਜਸ ਲੱਗਣਗੇ ਡਰਾਈਵਰ ਦੇ ਕਿੰਨੇ ਚਾਰਜਸ ਲੱਗਣਗੇ ਅਤੇ ਰਸਤੇ ਵਿੱਚ ਜਿੰਨੀਆਂ ਵੀ ਜਗ੍ਹਾ ਆਉਂਦੀਆਂ ਘੁੰਮਣ ਵਾਲੀਆਂ ਅਸੀਂ ਉੱਥੇ ਵੀ ਰੁਕ ਰੁਕ ਕੇ ਜਾਣਾ ਪਲੀਜ਼ ਸਾਨੂੰ ਦੱਸਿਆ ਜਾਵੇ ਕਿ ਤੁਹਾਡੀ ਜਿਹੜੀ ਗੱਡੀ ਦਾ ਰੈਂਟ ਹੈ ਉਹ ਕਿੰਨਾ ਪਵੇਗਾ ਅਤੇ ਤੁਹਾਡੇ ਡਰਾਈਵਰ ਦੇ ਚਾਰਜਸ ਕਿੰਨੇ ਬਣਨਗੇ ਕਿਲੋਮੀਟਰ ਦੇ ਹਿਸਾਬ ਨਾਲ ਸਾਨੂੰ ਦੱਸ ਦਿਓ ਕਿ ਇਹ ਕਿੰਨਾ ਵਧੀਆ ਅਤੇ ਕਿਵੇਂ ਹੀ

ਮਤਲਬ ਕਿ ਸਾਨੂੰ ਪੋਸੀਬਲ ਹੋ ਸਕਦਾ ਜਾਣਾ ਕਿ ਜੇ ਅਸੀਂ ਤਿੰਨ ਦਿਨ ਉੱਥੇ ਰਹੀਏ ਤਾਂ ਤੁਹਾਡੇ ਡਰਾਈਵਰ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਤੁਹਾਡਾ ਡਰਾਈਵਰ ਵਧੀਆ ਹੋਣਾ ਚਾਹੀਦਾ ਤਾਂ ਕਿ ਉਹ ਸੋਵੇ ਸੂਵੇ ਨਾ ਰਸਤੇ ਵਿੱਚ ਕੁਛ ਵੀ ਦੇਖ ਕੇ ਸਭ ਕੁਝ ਦੇਖ ਕੇ ਹੀ ਭੇਜਣਾ ਕਿ ਡਰਾਈਵਰ ਵਧੀਆ ਹੋਵੇ ਠੀਕ ਤਰ੍ਹਾਂ ਡਰਾਈਵ ਕਰੇ ਜੇ ਪੋਸੀਬਲ ਹੋ ਸਕੇ ਤਾਂ ਸਾਨੂੰ ਉਸ ਦਾ ਨੰਬਰ ਵੀ ਦੇ ਦਿੱਤਾ ਜਾਵੇ ਕਿਉਂਕਿ ਅਸੀਂ ਆਪ ਉਹਦੇ ਨਾਲ ਕੋਂਟੈਕਟ ਕਰਕੇ ਉਹਨੂੰ ਪੁੱਛ ਲਈਏ ਕਿ ਤੈਨੂੰ ਐਂ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਬਿਮਾਰੀ ਤਾਂ ਨਹੀਂ ਤਾਂ ਕਿ ਤੂੰ ਸਾਨੂੰ ਸਹੀ ਤਰ੍ਹਾਂ ਉੱਥੇ ਤੱਕ ਪਹੁੰਚਾ ਦੇਂਗਾ ਜਾਂ ਕੁਝ ਵੀ ਇਸ ਲਈ ਸਾਨੂੰ ਛੇਤੀ ਤੋਂ ਛੇਤੀ ਦੱਸ ਦਿੱਤਾ ਜਾਵੇ ਕਿ ਤੁਹਾਡੇ ਜਿਹੜੀ ਗੱਡੀ ਆ ਸਾਨੂੰ ਕਿਸ ਤਰ੍ਹਾਂ ਦੀ ਚਾਹੀਦੀ ਮਤਲਬ ਕਿ ਪੋਸੀਬਲ ਰਹੇਗੀ ਜਾਣ ਲਈ ਤਾਂ ਪਲੀਜ਼ ਸਾਨੂੰ ਛੇਤੀ ਤੋਂ ਛੇਤੀ ਕੋਂਟੈਕਟ ਕਰੋ ਦੱਸ ਦਿਓ ਅਤੇ ਸਾਨੂੰ ਉਸ ਦਾ ਨੰਬਰ ਵੀ ਦੇ ਦਿਓ ਤਾਂਕਿ ਅਸੀਂ ਉਸ ਨੂੰ ਆਪ ਵੀ ਪੁੱਛ ਲਈਏ